ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜੋ ਮੌਸਮ ਹਨ ਉਹ ਵੇਖਣ ਨੂੰ ਮਿਲਦੇ ਆ ਇਸੇ ਤਰ੍ਹਾਂ ਮੌਸਮ ਦੇ ਹਿਸਾਬ ਦੇ ਨਾਲ ਵੱਖ ਵੱਖ ਸਮੇਂ ਦੇ ਵਿੱਚ ਵੱਖ ਵੱਖ ਫਸਲਾਂ ਲਾਈਆਂ ਜਾਂਦੀਆਂ ਹਨ ਜਿਵੇਂ ਕਣਕ ਦੀ ਫਸਲ ਹੈ ਜਿਹੜੀ ਓ ਉਹ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਠੰਡ ਦੇ ਦਿਨਾਂ ਦੇ ਵਿੱਚ ਠੰਡੇ ਮੌਸਮ ਦੇ ਵਿੱਚ ਅਤੇ ਉਸ ਦੀ ਕਟਾਈ ਜੋ ਗਰਮੀਆਂ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਹੁੰਦੀ ਹੈ ਅਤੇ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਚਾਵਲ ਦੀ ਜੋ ਖੇਤੀ ਹੈ ਉਹ ਕੀਤੀ ਜਾਂਦੀ ਹੈ ਗਰਮੀਆਂ ਦੇ ਵਿੱਚ ਉਸ ਦੇ ਵਾਸਤੇ ਬਾਅਦ ਵਿੱਚ ਜੋ ਬਰਸਾਤੀ ਮੌਸਮ ਆ ਜਾਂਦਾ ਹੈ ਉਸ ਉਸ ਦੇ ਵੇਲੇ ਵੀ ਬਹੁਤ ਹੀ ਜ਼ਿਆਦਾ ਢੁਕਵਾਂ ਹੁੰਦਾ ਹੈ ਅਤੇ ਝੋਨੇ ਦੀ ਕਟਾਈ ਜੋ ਸਰਦੀਆਂ ਦੇ ਵਿੱਚ ਥੋੜ੍ਹੀਆਂ ਸਰਦੀਆਂ ਦੇ ਵਿੱਚ ਹੁੰਦੀ ਹੈ ਅਤੇ ਉਨ੍ਹਾਂ ਤੋਂ ਬਾਅਦ ਆਲੂ ਮਟਰ ਦੀ ਫਸਲ ਜੋ ਕੀਤੀ ਜਾਂਦੀ ਹੈ ਠੰਡ ਦੇ ਦਿਨਾਂ ਦੇ ਵਿੱਚ ਉਹ ਵੀ ਮੌਸਮ ਦੇ ਹਿਸਾਬ ਨਾਲ ਬਹੁਤ ਹੀ ਢੁੱਕਵੀਂ ਫਸਲ ਹੈ ਇਸ ਤਰ੍ਹਾਂ ਵੱਖ ਵੱਖ ਮੌਸਮਾਂ ਦੇ ਹਿਸਾਬ ਦੇ ਨਾਲ ਵੱਖ ਵੱਖ ਫਸਲਾਂ ਦੀ ਬਿਜਾਈ ਕੀਤੀ ਜਾਂਦੀ